ਹੈਲੋ ਹਾਂ ਜੀ ਮੇਰੇ ਕੋਲ ਬਹੁਤ ਜ਼ਿਆਦਾ ਕਿਤਾਬਾਂ ਹਨ ਜੋ ਮੈਂ ਪੜ੍ਹੀਆਂ ਹਨ ਅਤੇ ਉਹ ਕਰ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹਨ ਉਹਨਾਂ ਵਿੱਚੋਂ ਇੱਕ ਮੇਰੀ ਸਭ ਤੋਂ ਵਧੀਆ ਮਨ ਪਸੰਦ ਕਿਤਾਬ ਹੈ ਗੀਤਾ ਗੀਤਾ ਇੱਕ ਅਜਿਹੀ ਕਿਤਾਬ ਹੈ ਅਤੇ ਰਿਲੀਜ਼ਨ ਗ੍ਰੰਥ ਵੀ ਹੈ ਜਿਸ ਜਿਸ ਦੀ ਵਰਤੋਂ ਵਰਤੋਂ ਨਾਲ ਸਾਨੂੰ ਕੁਛ ਸਿੱਖਣ ਨੂੰ ਮਿਲਦਾ ਹੈ ਗੀਤਾ ਨਾ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਸੱਚ 'ਤੇ ਅਧਾਰਿਤ ਲਿਖਿਆ ਹੈ ਗੀਤਾ ਹੀ ਇੱਕ ਅਜਿਹੀ ਚੀਜ਼ ਹੈ ਗ੍ਰੰਥ ਹੈ ਜਿਸ ਨੂੰ ਪੜ੍ਹ ਕੇ ਇਸ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ ਇੱਕ ਅਹਿਸਾਸ ਹੁੰਦਾ ਕਿ ਉਹ ਦੁਨੀਆਂ ਵਿੱਚ ਕਿਵੇਂ ਆਇਆ ਹੈ ਅਤੇ ਕੀ ਕਰਨ ਆਇਆ ਹੈ ਉਸ ਨੂੰ ਉਸ ਦਾ ਉਪਦੇਸ਼ ਸਮਝ ਆਉਂਦਾ ਹੈ ਗੀਤਾ ਨਾਲ ਸਾਨੂੰ ਧਰਮ 'ਤੇ ਚੱਲਣ ਦਾ ਰਾਹ ਮਿਲਦਾ ਹੈ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਦੇ ਜੀਵਨ ਵਿੱਚ ਕਿੰਨੀਆਂ ਦੁੱਖ ਅਤੇ ਕਿੰਨੇ ਸੁੱਖ ਹੁੰਦੇ ਹਨ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਡੋਲਣਾ ਨਹੀ ਚਾਹੀਦਾ ਗੀਤਾਂ ਨਾਲ ਹੀ ਸਾਨੂੰ ਚੰਗਾ ਉਪਦੇਸ਼ ਮਿਲਦਾ ਹੈ ਮੇਰੇ ਗੀਤਾ ਮੈਨੂੰ ਇਸ ਲਈ ਗੀਤਾ ਦਾ ਸਾਰ ਸਭ ਤੋਂ ਵਧੀਆ ਲੱਗਦਾ ਹੈ ਮੈਂ ਹਮੇਸ਼ਾ ਗੀਤਾ ਦਾ ਦਾ ਗ੍ਰੰਥ ਬਹੁਤ ਜ਼ਿਆਦਾ ਵਾਰ ਪੜ੍ਹਦਾ ਹਾਂ ਧੰਨਵਾਦ ਜੀ